ਮੈਂ ਸਕੂਲ ਵਿੱਚ ਪੇਂਟਿੰਗ ਕਰਦਾ ਸੀ ਅਤੇ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਸੀ ਮੈਨੂੰ ਟੀਚਰਾਂ ਦਾ ਮੈਂ ਮਨਪਸੰਦ ਸਟੂਡੈਂਟ ਸੀ ਮੈਨੂੰ ਕਾਫੀ ਪੇਂਟਿੰਗ ਮੁਕਾਬਲਿਆਂ ਵਿੱਚ ਮੌਕਾ ਮਿਲਿਆ ਅਤੇ ਇਨਾਮ ਵੀ ਪ੍ਰਾਪਤ ਕੀਤੇ ਮੈਨੂੰ ਮੇਰੇ ਟੀਚਰਾਂ ਵੱਲੋਂ ਵੀ ਬਹੁਤ ਮਦਦ ਮਿਲੀ ਪੇਂਟਿੰਗ ਦੇ ਵਿੱਚ ਹੱਥ ਸਾਫ਼ ਕਰਕੇ ਜ਼ਿਆਦਾਤਰ ਮੈਂ ਪੇਂਟਿੰਗ ਸੀਨਰੀਆਂ ਬਣਾਉਂਦਾ ਸੀ ਜਿਸ ਤਰ੍ਹਾਂ ਪਹਾੜ ਝਰਨੇ ਰੁੱਖ ਇਹਨਾਂ 'ਤੇ ਮੇਰੀ ਜ਼ਿਆਦਾ ਹੱਥ ਸਾਫ਼ ਸੀ ਅਤੇ ਰੰਗਾਂ ਨਾਲ ਮੈਨੂੰ ਵੈਸੇ ਹੀ ਬਹੁਤ ਪਿਆਰ ਸੀ ਇਹ ਮੇਰੀ ਇੱਕ ਪੇਂਟਿੰਗ ਮੈਂ ਆਪਣੇ ਟੀਚਰ ਦੀ ਵੀ ਬਣਾਈ ਜੋ ਉਹਨਾਂ ਨੂੰ ਬਹੁਤ ਪਸੰਦ ਆਈ ਅਤੇ ਉਹ ਸਕੂਲ ਦੇ ਅੱਜ ਵੀ ਲੱ ਦੀਵਾਰ 'ਤੇ ਲੱਗੀ ਹੋਈ ਹੈ ਆਫਿਸ 'ਚ ਅਤੇ ਇਹ ਪੇਂਟਿੰਗ ਦਾ ਮੈਨੂੰ ਇਨਾਮ ਵੀ ਮਿਲਿਆ ਇਸ ਲਈ ਮੈਨੂੰ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਅਤੇ ਮੈਨੂੰ ਇਸ ਦੇ ਵਿੱਚ ਚੰਗੇ ਇਨਾਮ ਵੀ ਪ੍ਰਾਪਤ ਹੋਏ